ਸਰ ਮੈਂ ਮਿਰਾਜ ਵਾਰਿਸ ਹੈ ਅਤੇ ਮੈਂ ਸਰ ਮੈਂ ਤੁਹਾਡੇ ਪ੍ਰੀਤ ਢਾਬੇ ਤੋਂ ਖਾਣਾ ਮੰਗਵਾਇਆ ਸੀ ਜੀ ਮੇਰੇ ਘਰ ਕੋਈ ਰਿਸ਼ਤੇਦਾਰ ਆਏ ਸੀ ਥੋੜ੍ਹੇ ਗਿਆਰ੍ਹਾਂ ਕੁ ਵਜੇ ਪੌਣੇ ਗਿਆਰ੍ਹਾਂ ਕੁ ਵਜੇ ਮੇਰੇ ਘਰ ਰਿਸ਼ਤੇਦਾਰ ਆਏ ਸੀਗੇ ਤਾਂ ਫਿਰ ਮੈਂ ਤੁਹਾਡੇ ਇਹ ਦੁਕਾਨ ਪਰੋ ਐਮਰਜੈਂਸੀ ਖਾਣਾ ਮੰਗਵਾਇਆ ਅਤੇ ਉਹ 'ਚ ਦਾਲ ਮੱਖਣੀ ਸ਼ਾਹੀ ਪਨੀਰ ਰਸਗੁੱਲੇ 'ਤੇ ਹੋਰ ਵੀ ਬਹੁਤ ਮਿੱਠੀਆਂ ਚੀਜ਼ਾਂ ਸੀਗੀਆਂ ਅਤੇ ਹੁਣ ਮੇਰੇ ਰਿਸ਼ਤੇਦਾਰਾਂ ਨੂੰ ਫੋਨ ਆ ਗਿਆ ਐਮਰਜੈਂਸੀ 'ਤੇ ਉਹ ਘਰਾਂ ਚਲ ਗਏ ਫਿਰ ਉਹਨਾਂ ਨੂੰ ਜ਼ਰੂਰੀ ਕੰਮ ਪੈ ਗਿਆ ਉਹ ਚਲੇ ਗਏ ਹੁਣ ਤਾਂ ਕਿਰਪਾ ਕਰਕੇ ਮੇਰੇ ਇਹ ਔਡਰ ਨੂੰ ਕੈਂਸਲ ਕਰ ਦਿਉ ਉਹ 'ਚ ਸਰ ਮੇਰਾ ਸ ਇਹ ਪੈਸੇ ਮੈਂ ਔਨਲਾਈਨ ਪੇਮੈਂਟ ਕਰਤੇ ਸੀਗਾ ਤੁਹਾਨੂੰ ਤਾਂ ਕਿਰਪਾ ਕਰਕੇ ਮੇਰੇ ਪੈਸੇ ਵੀ ਵਾਪਸ ਕਰ ਦਿਉ ਅਤੇ ਜੇ ਖਾਣਾ ਇਹ ਘਰਾਂ ਆ ਗਿਆ ਫਿਰ ਇਹ ਨੇ ਵੇਸਟ ਹੋ ਜਾਣਾ ਇਸ ਕਰਕੇ ਇਹ ਕੋਈ ਖਾਊਂਗਾ ਨਹੀਂ ਫਿਰ ਇਹ ਪਏ ਰਹਿਣਾ ਇੱਥੇ ਇਹਨੇ ਕਿਰਪਾ ਕਰਕੇ ਇਹਨੂੰ ਕੈਂਸਲ ਕਰ ਦਿਉ ਇੱਥੇ ਖਾਣਾ ਇਹ ਖਾਣਾ ਨਹੀਂ ਕਿਸੇ ਨੇ